ਮੇਰੇ ਵਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਪਿੰਡ ਦੇ ਵਿੱਚ ਬਹੁਤ ਸਾਰੇ ਅਜਿਹੇ ਘਰੇਲੂ ਨੁਸਕੇ ਵਰਤੇ ਜਾਂਦੇ ਹਨ ਜਿਨ੍ਹਾਂ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਹੱਲ ਕੀਤਾ ਜਾ ਸਕਦਾ ਹੈ ਹੁਣ ਇੱਥੇ ਮੈਂ ਆਪ ਜੀ ਨੂੰ ਜ਼ੁਕਾਮ ਦੇ ਘਰੇਲੂ ਇਲਾਜ ਦੇ ਬਾਰੇ ਕੁਝ ਨੁਸਕੇ ਦੱਸਣ ਜਾ ਰਹੀ ਹਾਂ ਜੋ ਸਾਡੇ ਪਿੰਡ ਦੇ ਵਿੱਚ ਆਮ ਤੋਰ ਤੇ ਘਰੇਲੂ ਵਰਤੇ ਜਾਂਦੇ ਹਨ ਅਜਿਹੇ ਨੁਸਕੇ ਵਰਤਣ ਦੇ ਨਾਲ ਤੁਹਾਡਾ ਜੁਕਾਮ ਇੱਕ ਚੰਗੀ ਤਰ੍ਹਾਂ ਠੀਕ ਹੋ ਜਾਵੇਗਾ ਜਿਵੇਂ ਕੀ ਇਨ੍ਹਾਂ ਦੇ ਵਿੱਚੋਂ ਕਈ ਐਦਾਂ ਦੇ ਨੁਸਕੇ ਹਨ ਜੋ ਕੀ ਬਹੁਤ ਹੀ ਆਮ ਅਤੇ ਬਹੁਤ ਹੀ ਸੋਖੇ ਤਰੀਕੇ ਨਾਲ ਵਰਤੇ ਜਾ ਸਕਦੇ ਹਨ ਸਾਨੂੰ ਇਨ੍ਹਾਂ ਨੁਸਕਿਆਂ ਨੂੰ ਵਰਤਣ ਤੋਂ ਬਾਦ ਕਿਸੇ ਵੀ ਦਵਾਈ ਦੀ ਜਾਂ ਕੋਈ ਜੜ੍ਹੀ ਬੂਟੀ ਦੀ ਜਰੂਰਤ ਨਈਂ ਪਏਗੀ ਜਿਵੇਂ ਕੀ ਸਭ ਤੋਂ ਪਹਿਲਾਂ ਆ ਜਾਂਦਾ ਹੈ ਹਲਦੀ ਵਾਲਾ ਦੁੱਧ ਰਾਤ ਨੂੰ ਸੌਨ ਤੋਂ ਪਹਿਲਾਂ ਜੇਕਰ ਅਸੀਂ ਹਲਦੀ ਵਾਲਾ ਦੁੱਧ ਜਾਂ ਦੁੱਧ ਵਿੱਚ ਹਲਦੀ ਕੁਝ ਏਦਾਂ ਦਾ ਹੋਰ ਪਾ ਕੇ ਪੀਵਾਂਗੇ ਤਾਂ ਇਸਦੇ ਨਾਲ ਸਾਡੇ ਜੁਕਾਮ ਵਿੱਚ ਬਹੁਤ ਰਾਹਤ ਆਂਦੀ ਹੈ ਦੂਸਰਾ ਅਦਰਕ ਵਾਲੀ ਚਾਹ ਅਦਰਕ ਵਾਲੀ ਚਾਹ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਸਾਨੂੰ ਅਦਰਕ ਵਾਲੀ ਚਾਹ ਪੀਣੀ ਚਾਈਦੀ ਹੈ ਅਸੀਂ ਉਸਦੇ ਵਿੱਚ ਤੁਲਸੀ ਵੀ ਅਗਰ ਪਾ ਕੇ ਪੀਵਾਂਗੇ ਤੇ ਇਹ ਹੋਰ ਵਧੇਰੇ ਵਧੀਆ ਹੋ ਜਾਂਦਾ ਹੈ ਹੋਰ ਆ ਜਾਂਦਾ ਹੈ ਜਿਵੇਂ ਕੀ ਸਾਨੂੰ ਭਾਫ਼ ਲੈਣੀ ਚਾਹੀਦੀ ਪਾਣੀ ਨੂੰ ਉਬਾਲ ਕੇ ਉਸਦੀ ਭਾਫ਼ ਲੈਣ ਦੇ ਨਾਲ ਜੁਕਾਮ ਠੀਕ ਹੋ ਜਾਂਦਾ ਹੈ ਜਾਂ ਫੇਰ ਸਾਨੂੰ ਤਾਜਾ ਪਾਣੀ ਪੀਂਦੇ ਰਹਿਣਾ ਚਾਈਦਾ ਹੈ ਕਈ ਵਾਰੀ ਪਿੰਡ ਦੇ ਵਿੱਚ ਜਾਂ ਬਾਹਰ ਸ਼ਹਿਰਾਂ ਦੇ ਵਿੱਚ ਪਾਣੀ ਚੰਗੀ ਤਰ੍ਹਾਂ ਸਾਫ਼ ਨਈਂ ਆਂਦਾ ਇਸ ਲਈ ਸਾਨੂੰ ਪਾਣੀ ਨੂੰ ਉਬਾਲ ਕੇ ਜਾਂ ਤਾਜਾ ਪਾਣੀ ਪੀਣਾ ਚਾਈਦਾ ਹੈ ਜੋ ਕੀ ਸਾਡੀ ਸਿਹਤ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ ਹੋਰ ਅਜਿਹੇ ਨੁਸਕੇ ਹਨ ਜਿਹੜੇ ਕੀ ਸਾਡੇ ਘਰੇਲੂ ਹੀ ਆਮ ਤੋਰ ਤੇ ਵਰਤੇ ਜਾਂਦੇ ਹਨ ਜਿਨ੍ਹਾਂ ਦੇ ਨਾਲ ਆਮ ਅਜਿਹੀਆਂ ਬਿਮਾਰੀਆਂ ਦਾ ਅਸਾਨੀ ਦੇ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ ਇਹ ਨੁਸਕੇ ਸਾਡੇ ਦਾਦਾ ਜੀ ਪੜਦਾਦਾ ਜੀ ਤੋਂ ਚਲਦੇ ਆ ਰਹੇ ਹਨ ਇਹ ਆਮ ਘਰੇਲੂ ਨੁਸਕੇ ਹਨ ਜੋ ਪਿੰਡਾਂ ਦੇ ਵਿੱਚ ਵਰਤੇ ਜਾਂਦੇ ਹਨ ਇਨ੍ਹਾਂ ਨੂੰ ਵਰਤਣ ਦੇ ਨਾਲ ਸਾਡੀ ਸਿਹਤ ਦੇ ਵਿੱਚ ਕਾਫ਼ੀ ਸੁਧਾਰ ਆਂਦਾ ਹੈ ਜੇਕਰ ਕਿਸੇ ਨੂੰ ਹਲਕਾ ਜੁਕਾਮ ਜਾਂ ਥੋੜਾ ਜਿਆਦਾ ਜੁਕਾਮ ਲੱਗ ਜਾਂਦਾ ਹੈ ਤਾਂ ਉਸਦਾ ਨਿਚੋੜ ਏਹੀ ਹੈ ਕੀ ਸਾਨੂੰ ਹਲਦੀ ਵਾਲਾ ਦੁੱਧ ਪਾਣੀ ਨੂੰ ਗਰਮ ਕਰਕੇ ਪੀਣਾ ਜਾਂ ਫਿਰ ਭਾਫ਼ ਲੈਣਾ ਅਜਿਹੇ ਨੁਸਖੇ ਅਪਨਾਉਣੇ ਚਾਈਦੇ ਹਨ ਹੋਰ ਅਜਿਹੇ ਨੁਸਕਿਆਂ ਦੇ ਵਿੱਚ ਇਹ ਵੀ ਆ ਜਾਂਦਾ ਹੈ ਕੀ ਅਗਰ ਅਸੀਂ ਵਿਟਾਮਿਨ ਸੀ ਜਿਵੇਂ ਕੀ ਸੀਤਾਫਲ ਸੰਤਰਾ ਅਨਾਰ ਐਦਾਂ ਦੇ ਸੇ ਫਲ਼ਾਂ ਦਾ ਸੇਵਨ ਕਰਾਂਗੇ ਤਾਂ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਧੰਨਵਾਦ